ਮੈਂ ਇਹ ਚਾਹੁੰਦਾ ਹਾਂ ਕਿ ਭਵਿੱਖ ਵਿੱਚ ਜਿਹੜੀ ਮੇਰੀ ਸੁਰੱਕਸ਼ਾ ਹੈਗੀ ਹੈ ਉਹ ਮੇਰੇ ਤੱਕ ਹੀ ਸੀਮਿਤ ਰਹੇ ਕੋਈ ਹੋਰ ਜਿਹੜਾ ਹੈਗਾ ਉਹਨੂੰ ਕੋਈ ਦੇਖ ਨਾ ਸਕੇ ਜਿਵੇਂ ਫੇਸਬੁਕ 'ਤੇ ਆਪਾਂ ਆਪਦਾ ਸਾਰਾ ਡੇਟਾ ਅਪਲੋਡ ਕਰ ਦਿੰਦੇ ਆ ਆਪਦੀਆਂ ਫੋਟੋਆਂ ਅਪਲੋਡ ਕਰ ਦਿੰਦੇ ਆ ਜਨੀ ਖਾਣੀ ਆਪਣੀ ਇਨਫੋਰਮੇਸ਼ਨ ਅੱਜ ਕੱਲ੍ਹ ਹੈਗੀ ਜਿਹੜੀ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਆ ਸੋਸ਼ਲ ਮੀਡੀਆ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਕੁਝ ਲੋਕਾਂ ਤੱਕ ਹੀ ਸੀਮਿਤ ਰਹੇ ਜਿਹਨਾਂ ਨੂੰ ਮੈਂ ਜਾਣਦਾ ਹੈਗਾ ਸਾ ਹਰੇਕ ਕੋਈ ਉਹਨੂੰ ਦੇਖ ਨਾ ਸਕੇ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜੇ ਅਕਾਊਂਟ ਹੈਗੇ ਵਭਿੰਨ ਵਭਿੰਨ ਤਰ੍ਹਾਂ ਦੇ ਹੈਕ ਹੋ ਜਾਂਦੇ ਆ ਲੋਕ ਉਹਨਾਂ ਤੇ ਚੜ੍ਹ ਕੇ ਕੋਈ ਵੀ ਆਪਦੀ ਇਨਫੋਰਮੇਸ਼ਨ ਕੱਢ ਸਕਦੇ ਹੈਗੇ ਆ ਸਾਡੇ ਬਾਰੇ ਕੋਈ ਵੀ ਇਨਫੋਰਮੇਸ਼ਨ ਕੱਢ ਸਕਦੇ ਆ ਉਹਦੇ 'ਤੇ ਕੁਝ ਵੀ ਕਰ ਸਕਦੇ ਕੋਈ ਵੀ ਫੋਟੋ ਅਪਲੋਡ ਕਰ ਸਕਦੇ ਹੈਗੇ ਆ ਇਹ ਫਿਊਚਰ 'ਚ ਨਹੀਂ ਹੋਣਾ ਚਾਹੀਦਾ ਜਿਵੇਂ ਗੱਡੀਆਂ ਹੈਗੀਆਂ ਮੈਂ ਵੀ ਜੇ ਇਹ ਵੀ ਸੋਚਦਾ ਆ ਕਿ ਜਿਵੇਂ ਐਕਸੀਡੈਂਟ ਹੈਗੇ ਆ ਉਹਨਾਂ ਬਾਰੇ ਸੋਚ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਗੱਡੀਆਂ ਮੰਨਣਗੀਆਂ ਅੱਜ 'ਚ ਜਿਹੜੇ ਹੈਗੇ ਐਕਸੀਡੈਂਟ ਜਿਹੜੇ ਘੱਟ ਹੋਣ ਅਤੇ ਜਿਹੜੇ ਗੂਗਲ ਮੈਪ ਹੈਗੇ ਆ ਅੱਜ ਕੱਲ੍ਹ ਜੀ ਗੂਗਲ ਮੈਪ ਜਿਹੜਾ ਹੈਗਾ ਕਈ ਵਾਰੀ ਕਿਤੇ ਲਾਇਆ ਜਾਂਦਾ ਕਈ ਵਾਰੀ ਕਿਤੇ ਲਾਇਆ ਜਾਂਦਾ ਕਈ ਵਾਰ ਕਿਤੇ ਏਟੀਐਮ ਦਿਖਾਉਂਦਾ ਹੈਗਾ ਉੱਥੇ ਹੁੰਦਾ ਨਹੀਂ ਹੈਗਾ ਏਟੀਐਮ ਫਿਰ ਵੀ ਉਹ ਦਿਖਾਈ ਜਾਂਦਾ ਹੈਗਾ ਐਵੇਂ ਫਿਊਚਰ 'ਚ ਨਹੀਂ ਹੋਣਾ ਚਾਹੀਦਾ ਜਿਹੜੇ ਚੀਜ਼ ਜਿੱਥੇ ਹੈ ਉੱਥੇ ਹੋਣੀ ਚਾਹੀਦੀ ਹੈ ਜਾਂ ਛੋਟੀਆਂ ਤੋਂ ਛੋਟੀਆਂ ਸੜਕਾਂ ਜਾਂ ਛੋਟੀਆਂ ਤੋਂ ਛੋਟੀਆਂ ਗਲੀਆਂ ਗੂਗਲ ਮੈਪ ਨੇ ਚੰਗੀ ਤਰ੍ਹਾਂ ਸ਼ੋ ਹੋਣੀਆਂ ਚਾਹੀਦੀਆਂ ਹਨ ਅਤੇ ਜਿਹੜਾ ਪੇਮੈਂਟ ਮੈਥੜ ਆ ਕਈ ਵਾਰੀ ਅੱਜ ਕੱਲ੍ਹ ਫੇਲ ਹੋ ਜਾਂਦਾ ਟਰਾਂਸੈਕਸ਼ਨ ਹੋ ਜਾਂਦਾ ਕਿੰਨੀ ਪੰਗੇ ਪੈ ਜਾਂਦੇ ਆ ਰਾਤ ਨੂੰ ਐਵੇਂ ਹੋ ਜਾਂਦਾ ਐਵੇ ਹੋਣਾ ਨੀ ਚਾਹੀਦਾ ਇੰਟਰਨੈਟ ਜਿਹੜਾ ਕਦੇ ਵੀ ਕਰੈਸ਼ ਨਹੀਂ ਹੋਣਾ ਚਾਹੀਦਾ ਹਰ ਸਮੇਂ ਜਿਹੜਾ ਹੈਗਾ ਇੰਟਰਨੈਟ ਦੀ ਜਿਹੜੀ ਹੈਗੀ ਆ ਸੁਵਿਧਾ ਹਰ ਸਮੇਂ ਹੋਣੀ ਚਾਹੀਦੀ ਆ ਹਰ ਕੋਨੇ 'ਚ ਹੋਣੀ ਚਾਹੀਦੀ ਆ ਜਿਵੇਂ ਕਈ ਇਲਾਕੇ ਹੈਗੇ ਆ ਜਿੱਥੇ ਇੰਟਰਨੈਟ ਦੀ ਜਿਹੜੀ ਸੁਵਿਧਾ ਹੈਗੀ ਉਹ ਘੱਟ ਹੈਗੀ ਆ ਉੱਥੇ ਇੰਟਰਨੈਟ ਚੰਗੀ ਤਰ੍ਹਾਂ ਮਿਲਦਾ ਨਹੀਂ ਉੱਥੇ ਚੰਗੀ ਤਰ੍ਹਾਂ ਉਹਦਾ ਕਨੈਕਸ਼ਨ ਨਹੀਂ ਆਉਂਦਾ ਚੰਗੀ ਤਰ੍ਹਾਂ ਆਪਾਂ ਉੱਥੇ ਜਾ ਕੇ ਇੰਟਰਨੈਟ ਬਾਰੇ ਕੁਝ ਕਰ ਨਹੀਂ ਸਕਦੇ